ਸ਼੍ਰੀਮਾਨ ਜੀ ਮੈਂ ਓਵਰ ਏਜੰਸੀ ਦੀ ਨਾ ਕਾਰ ਬੁੱਕ ਕੀਤੀ ਸੀਗੀ ਬੇਟੀ ਨੂੰ ਮਿਲਣ ਜਾਣਾ ਸੀ ਜਲੰਧਰ ਅਤੇ ਅੱਜ ਕੱਲ੍ਹ ਜਲੰਧਰ ਫਗਵਾੜਾ ਦੇ ਕੋਲ ਕਿਸਾਨਾਂ ਨੇ ਗੰਨੇ ਦੀ ਅਦਾਇਗੀ ਨੂੰ ਲੈ ਕੇ ਬਹੁਤ ਵੱਡਾ ਜਾਮ ਲਾਇਆ ਹੋਇਆ ਹੈ ਮੈਂ ਤੁਹਾਨੂੰ ਐਡਵਾਂਸ ਵਜੋਂ ਪੰਦਰ੍ਹਾਂ ਸੌ ਰੁਪਈਆ ਪੇਸ਼ਗੀ ਰਕਮ ਦੇ ਦਿੱਤੀ ਸੀ ਪਰ ਉਹ ਗ ਆਪਣਾ ਕਿਸਾਨਾਂ ਵੱਲੋਂ ਲਾਇਆ ਗਿਆ ਜਾਮ ਹੋਣ ਕਰਕੇ ਮੈਂ ਉੱਥੇ ਹੁਣ ਜਾਣ ਤੋਂ ਅਸਮਰੱਥ ਹਾਂ ਸਾਡਾ ਇਹ ਪ੍ਰੋਗਰਾਮ ਕੈਂਸਲ ਹੋ ਗਿਆ ਇਸ ਕਰਕੇ ਤੁਹਾਨੂੰ ਇੱਕ ਬੇਨਤੀ ਕੀਤੀ ਜਾਂਦੀ ਆ ਵੀ ਜਿਹੜਾ ਜੋ ਅਸੀਂ ਤੁਹਾਨੂੰ ਐਡਵਾਂਸ ਵਜੋਂ ਪੰਦਰ੍ਹਾ ਸੌ ਰੁਪਈਆ ਤੁਹਾਨੂੰ ਦਿੱਤਾ ਸੀ ਕਿਰਪਾ ਕਰਕੇ ਉਹ ਸਾਨੂੰ ਵਾਪਸ ਦਿੱਤਾ ਜਾਵੇ ਤਾਂ ਕਿ ਜਿਹੜਾ ਹੈ ਅਸੀਂ ਕਿਸੇ ਦਿਨ ਫੇਰ ਪ੍ਰੋਗਰਾਮ ਬਣਾ ਕੇ ਤੁਹਾਡੇ ਏਜੰਸੀ ਦੇ ਰਾਹੀਂ ਅਸੀਂ ਫੇਰ ਟੈਕਸੀ ਬੁੱਕ ਕਰ ਲਵਾਂਗੇ ਹੁਣ ਸਾਨੂੰ ਇਸ ਪੇਸ਼ਗੀ ਜਿਹੜੀ ਰਕਮ ਆ ਸਾਨੂੰ ਵਾਪਸ ਕੀਤੀ ਜਾਵੇ